ਹਾਂਜੀ ਅਸੀਂ ਵੱਖ ਵੱਖ ਮੌਸਮਾਂ ਦਾ ਕਾਫੀ ਆਨੰਦ ਮਾਣਦੇ ਹਾਂ ਕਿਉਂਕਿ ਮੌਸਮ ਦੇ ਹਿਸਾਬ ਨਾਲ ਹੀ ਸਭ ਕੁਝ ਵਧੀਆ ਲੱਗਦਾ ਹੈ ਜਿਵੇਂ ਕਿ ਲਾ ਲਓ ਕਿ ਗਰਮੀਆਂ ਵਿੱਚ ਜਦੋਂ ਗਰਮੀਆਂ ਦੀਆਂ ਛੁੱਟੀਆਂ ਪੈਂਦੀਆਂ ਹਨ ਅਤੇ ਹਰ ਇੱਕ ਬੱਚੇ ਦੀ ਰੀਝ ਹੁੰਦੀ ਹੈ ਕਿ ਅਸੀਂ ਆਪਣੇ ਨਾਨਕੇ ਜਾਈਏ ਮਾਮਾ ਮਾਮੀ ਕੋਲ ਜਾਈਏ ਅਤੇ ਨਾਨਾ ਨਾਨੀ ਕੋਲ ਜਾ ਕੇ ਖੇਡੀਏ ਉੱਥੇ ਜਾ ਕੇ ਕੁਝ ਗਰਮ ਗਰਮ ਪਕੌੜੇ ਪਾਪੜ ਵੜੀਆਂ ਅਤੇ ਨਾਨੀ ਕੋਲੋਂ ਰਾਤ ਨੂੰ ਬਾਤਾਂ ਸੁ ਸੁਣੀਏ ਖੇਡੀਏ ਅਤੇ ਉੱਥੇ ਜਾਈਏ ਇਹ ਮਲਕੀ ਹਰ ਇੱਕ ਬੱਚੇ ਦੀ ਪਹਿਲੀ ਪਸੰਦ ਹੁੰਦੀ ਹੈ ਕਿ ਆਪਣੇ ਨਾਨਕੇ ਹੀ ਜਾਈਏ ਬਾਕੀ ਆ ਗਿਆ ਜੀ ਅੱਗੇ ਸਾਓਣ ਦਾ ਮਹੀਨਾ ਸਾਓਣ ਦੇ ਮਹੀਨੇ ਵਿੱਚ ਜੀ ਕਾਫੀ ਆਨੰਦ ਆਉਂਦਾ ਹੈ ਲੋਕ ਘਰਾਂ ਵਿੱਚ ਖੀਰ ਮਾਲ ਪੂੜੇ ਆਦਿ ਕਈ ਤਰ੍ਹਾਂ ਦੇ ਪਕਵਾਨ ਬਣਾਉਂਦੇ ਹਨ ਅਤੇ ਮੌਸਮ ਦਾ ਆਨੰਦ ਮਾਣਦੇ ਹਨ ਅਤੇ ਸਰਦੀਆਂ ਜਦੋਂ ਆਉਂਦੀਆਂ ਹਨ ਅਤੇ ਹਰ ਕੋਈ ਧੁੱਪ ਸੇਕਦਾ ਹੈ ਉੱਥੇ ਗਰਮ ਗਰਮ ਸਨੈਕਸ ਚਾਹ ਪਕੌੜੇ ਜਲੇਬੀਆਂ ਖਾਣਾ ਪਸੰਦ ਕਰਦੇ ਹਨ ਅਤੇ ਅੱਗ ਸੇਕਦੇ ਹਨ ਜੋ ਕਿ ਬਹੁਤ ਵਧੀਆ ਹੈ ਅਤੇ ਸਾਨੂੰ ਹਰ ਇੱਕ ਮੌਸਮ ਦਾ ਆਨੰਦ ਮਾਣਨਾ ਚਾਹੀਦਾ ਹੈ